ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਟੂਰਿਸਟ ਗਾਈਡ ਮਨਪ੍ਰੀਤ ਸਿੰਘ ਬੋਲ ਰਹੇ ਓ ਜੀ ਹਾਂਜੀ ਮੈਨੂੰ ਨਾ ਪੰਜਾਬ ਘੁੰਮਣਾ ਸੀ ਪੰਜਾਬ ਵਿੱਚ ਮੈਨੂੰ ਫੇਮਸ ਪਲੇਸਿਜ਼ ਬਾਰੇ ਤੁਸੀਂ ਦੱਸ ਸਕਦੇ ਓ ਔਰ ਘੁੰਮਾ ਸਕਦੇ ਓ ਉੱਥੇ ਤੁਹਾਡੇ ਚਾਰਜਿੰਸ ਕੀ ਹੋਣਗੇ ਜੀ ਮੈਨੂੰ ਸਾਰੀ ਡੀਟੇਲ ਦੱਸਦੋ ਜੀ ਇੱਕ ਵਾਰ ਅੱਛਾ ਜੀ ਠੀਕ ਹਾਂਜੀ ਹਾਂਜੀ ਹਾਂਜੀ ਗੌਲਡਨ ਟੈਂਪਲ ਅੰਮ੍ਰਿਤਸਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕੁੱਲ ਮਿਲਾ ਕੇ ਮੈਨੂੰ ਆਈਡੀਆ ਜਿਹਾ ਦੱਸਦੋ ਵੀ ਕਿੰਨਾ ਖਰਚਾ ਹੋਜੇਗਾ ਔਰ ਰਹਿਣ ਦਾ ਪ੍ਰਬੰਧ ਹੋਵੇਗਾ ਜੀ ਕੀਤੇ ਸਰ ਠੀਕ ਹੈ ਜੀ ਸਰ ਠੀਕ ਹੈ ਜੀ ਠੀਕ ਹੈ ਸਰ ਥੈਂਕ ਯੂ ਜੀ ਠੀਕ ਠੀਕ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸਰ ਕੱਲ੍ਹ ਚੱਲਾਂਗੇ ਜੀ ਕੱਲ੍ਹ ਮੌਰਨਿੰਗ ਦਾ ਰੱਖੋ ਕੱਲ੍ਹ ਮੌਰਨਿੰਗ ਦਾ ਚੱਲੋ ਜੀ ਗੌਲਡਨ ਗੌਲਡਨ ਟੈਂਪਲ ਫਸਟ ਹੋਵੇਗਾ ਔਰ ਓਨ ਦ ਵੇਅ ਰਸਤੇ 'ਚ ਜਿਹੜੇ ਵੀ ਹੋਣਗੇ ਗੁਰੂ ਘਰ ਜਾਂ ਰੀਲੀਜੀਏਸ ਪਲੇਸਿਜ਼ 'ਤੇ ਜਾਂ ਜਿਹੜੇ ਵੀ ਤੁਹਾਨੂੰ ਪਤਾ ਹੈ ਹਾਂਜੀ ਹਾਂ ਠੀਕ ਹੈ ਸਰ ਠੀਕ ਹੈ ਕੱਲ੍ਹ ਦਾ ਰੱਖੋ ਸਰ ਮੌਰਨਿੰਗ ਦਾ ਮੈਂ ਤੁਹਾਨੂੰ ਇੱਕ ਵਾਰ ਈਵਨਿੰਗ 'ਚ ਕਾਲ ਕਰਕੇ ਪੱਕਾ ਤੁਹਾਨੂੰ ਦੱਸ ਦਵਾਂਗੀ ਕੀ ਕੱਲ੍ਹ ਕਿੰਨੇ ਵਜੇ ਚੱਲਣਾ ਹੈ ਜੀ ਓਕੇ ਸਰ ਥੈਂਕ ਯੂ